ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਨੂੰ ਦਸ ਗੁਰੂ ਸਾਹਿਬਾਨ ਦੀ ਛੋਹ ਪ੍ਰਾਪਤ ਹੈ ਇਸ ਦੇ ਇਤਿਹਾਸ ਵਿੱਚ ਬਹੁਤ ਕੁਛ ਸਮਾਇਆ ਹੋਇਆ ਹੈ ਜਿਸਦੇ ਵਿੱਚ ਸਾਡਾ ਇਤਿਹਾਸ ਭੰਗੜਾ ਗਿੱਧੇ ਲੋਕ ਨਾਚ ਚਿੱਤਰਕਾਰੀ ਅਤੇ ਬਹੁਤ ਸਰੋਤ ਹਨ ਚੱਪੜਚਿੜੀ ਵਿਖੇ ਬਾਬਾ ਬੰਦਾ ਬਹਾਦਰ ਜੀ ਨਾਲ ਜੁੜੀ ਹੋਈ ਯਾਦ ਸਥਾਪਿਤ ਕੀਤੀ ਹੋਈ ਹੈ ਇਸ ਤੋਂ ਇਲਾਵਾ ਸਿੱਖ ਇਤਿਹਾਸ ਨੂੰ ਦਰਸਾਉਂਦੇ ਹੋਏ ਅਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖਾਲਸਾ ਲੋਕਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਵਧੀਆ ਸਾਧਨ ਹੈ ਪੰਜਾਬ ਵਿੱਚ ਭੰਗੜਾ ਅਤੇ ਗਿੱਧਾ ਮਸ਼ਹੂਰ ਲੋਕ ਨਾਚ ਹਨ ਪੰਜਾਬ ਦੀ ਚਿੱਤਰਕਾਰੀ ਵਿੱਚ ਸਭ ਤੋਂ ਵੱਡਾ ਨਾਮ ਸੋਭਾ ਸਿੰਘ ਜੀ ਦਾ ਹੈ ਜਿਨ੍ਹਾਂ ਨੇ ਆਪਣੀ ਚਿੱਤਰਕਾਰੀ ਦੇ ਨਾਲ ਪੰਜਾਬ ਦੇ ਇਤਿਹਾਸ ਸੱਭਿਆਚਾਰ ਨੂੰ ਵਰਕੇ 'ਤੇ ਉਤਾਰਿਆ ਹੈ ਸੋ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਇਸ ਕੌਮ ਦੇ ਲਈ ਪ੍ਰੇਰਨਾ ਸਰੋਤ ਹੈ ਅਤੇ ਸਾਇੰਸ ਦੇ ਨਾਲ ਸੰਬੰਧਿਤ ਸਾਇੰਸ ਸਿਟੀ ਵੀ ਪੰਜਾਬ ਵਿੱਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਜੋ ਕਿ ਕਪੂਰਥਲਾ ਜਲੰਧਰ ਰੋਡ 'ਤੇ ਹੈ ਸਥਿਤ ਹੈ ਇਸ ਵਿੱਚ ਸਾਇੰਸ ਦੇ ਨਾਲ ਸੰਬੰਧਿਤ ਜੋ ਵੀ ਖੋਜਾਂ ਹੋਈਆਂ ਹਨ ਜਾਂ ਸਾਡੇ ਸਰੀਰਕ ਸੰਰਚਨਾ ਹੈ ਉਸਦੇ ਲਈ ਬਹੁਤ ਵੱਡੇ ਸਾਧਨ ਜੁਟਾ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਗਿਆਨ ਵਿੱਚ ਵਾਧਾ ਕੀਤਾ ਜਾ ਰਿਹਾ ਹੈ